ਇਸ ਖੇਤਰ ਦਾ ਇਤਿਹਾਸ ਸਦੀਆਂ ਤੋਂ ਵੱਖ ਵੱਖ ਸਮਰਾਜਾਂ ਅਤੇ ਰਾਜਵੰਸ਼ਾਂ ਵਿੱਚ ਵੰਡਿਆ ਗਿਆ ਹੈ ਇਤਿਹਾਸ ਵਿੱਚ ਰਾਜਵੰਸ਼ਾ ਨੇ ਆਪਣਾ ਰਾਜ ਕਾਇਮ ਕਰਨ ਲਈ ਬਹੁਤ ਸਾਰੇ ਯਤਨ ਕੀਤੇ ਹਨ ਉਹਨਾਂ ਨੂੰ ਬਹੁਤ ਸਾਰੀ ਮਿਹਨਤ ਕਰਨੀ ਪਈ ਹੈ ਉਹਨਾਂ ਨੂੰ ਆਪਣੀ ਰਾਜ ਗੱਦੀ ਕਾਇਮ ਰੱਖਣ ਲਈ ਬਹੁਤ ਸਾਰੇ ਯਤਨ ਕਰਨੇ ਪਏ ਤਾਂ ਜੋ ਉਨ੍ਹਾਂ ਦਾ ਰਾਜ ਹੋਇਆ ਹੈ ਉਹਨਾਂ ਨੇ ਬਹੁਤ ਲੋਕਾਂ ਦੀ ਸੇਵਾ ਕੀਤੀ ਹੈ ਉਹਨਾਂ ਨੇ ਗਰੀਬ ਬੰਦਿਆਂ ਦੀ ਬਹੁਤ ਜ਼ਿਆਦਾ ਸੇਵਾ ਕੀਤੀ ਹੈ ਰਾਜਵੰਸ਼ਾਂ ਨੇ ਆਪਣੀ ਗੱਦੀ ਕਾਇਮ ਰੱਖਣ ਲਈ ਬਹੁਤ ਸਾਰੇ ਯਤਨ ਕੀਤੇ ਹਨ ਉਹਨਾਂ ਨੇ ਇਤਿਹਾਸ ਵਿੱਚ ਆਪਣੀ ਜਗ੍ਹਾ ਬਣਾਉਣ ਲਈ ਬਹੁਤ ਸਾਰੇ ਯਤਨ ਕੀਤੇ ਹਨ ਰਾਜਵੰਸ਼ਾਂ ਨੇ ਬਹੁਤ ਸਾਰੇ ਚੰਗੇ ਕੰਮ ਵੀ ਕੀਤੇ ਹਨ